ਮੋਹਾਲੀ ਜ਼ਿਲ੍ਹੇ ਦੀ ਇੱਕ ਅਮੀਰ ਸੱਭਿਆਚਾਰਕ ਵਿਰਾਸਤ ਹੈ ਪਰ ਇਹ ਵਿਸ਼ਵ ਪੱਧਰ 'ਤੇ ਸਥਾਨਕ ਕਹਾਣੀਆਂ ਜਾਂ ਕਥਾਵਾਂ ਲਈ ਖਾਸ ਤੌਰ 'ਤੇ ਮਸ਼ਹੂਰ ਨਹੀਂ ਹੈ ਹਾਲਾਂਕਿ ਇਸਦੇ ਜ਼ਿਲ੍ਹੇ ਦੇ ਇਤਿਹਾਸ ਅਤੇ ਸੱਭਿਆਚਾਰ ਦੇ ਕੁਝ ਪਹਿਲੂ ਹਨ ਮੋਹਾਲੀ ਜਿਲ੍ਹੇ ਦੇ ਕਸਬੇ ਖਰੜ ਵਿੱਚ ਇੱਕ ਪੁਰਾਣਾ ਕਿਲ੍ਹਾ ਮੰਨਿਆਂ ਜਾਂਦਾ ਹੈ ਜਿਸ ਦੀ ਇਤਿਹਾਸਿਕ ਮਹੱਤਤਾ ਹੈ ਹਾਲਾਂਕਿ ਇਸ ਦੀਆਂ ਕਥਾਵਾਂ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਨਹੀਂ ਹਨ ਕਿਲ੍ਹੇ ਦੀ ਹੋਂਦ ਖੇਤਰ ਦੇ ਇਤਿਹਾਸਿਕ ਮਹੱਤਵ ਵੱਲ ਇਸ਼ਾਰਾ ਕਰਦੀ ਹੈ ਮੋਹਾਲੀ ਦੇ ਦਿਲ ਵਿੱਚ ਹੈ ਪੰਜਾਬ ਇਹ ਖੇਤਰ ਭਾਰਤ ਦਾ ਅਨਾਜ ਭੰਡਾਰ ਵੱਲੋਂ ਜਾਣਿਆ ਜਾਂਦਾ ਹੈ ਜ਼ਿਲ੍ਹੇ ਦੇ ਸੱਭਿਆਚਾਰ ਅਤੇ ਪਰੰਪਰਾਵਾਂ ਖੇਤੀਬਾੜੀ ਨਾਲ਼ ਨਿਉਂਦ ਜੋੜੀਆਂ ਹੋਈਆਂ ਹਨ ਅਤੇ ਇਹ ਵੱਖ ਵੱਖ ਸਥਾਨਕ ਤਿਉਹਾਰਾਂ ਸੰਗੀਤ ਅਤੇ ਨਾਚ ਦੇ ਰੂਪ ਵਿੱਚ ਝਲਕਦਾ ਹੈ ਸ਼ਹਾਲਦ ਹੀ ਸਮੇਂ ਵਿੱਚ ਮੋਹਾਲੀ ਨੇ ਪੰਜਾਬ ਦੇ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਨਾਲ਼ ਨੇੜਤਾ ਦੇ ਕਾਰਨ ਤੇਜ਼ੀ ਨਾਲ਼ ਸ਼ਹਿਰੀਕਰਨ ਦੇਖਿਆ ਹੈ ਇਸ ਵਾਧੇ ਨੇ ਜ਼ਿਲ੍ਹੇ ਦੇ ਲੇ ਅਤੇ ਜਨਸੰਖਿਆਂ ਨੂੰ ਬਦਲ ਦਿੱਤਾ ਹੈ ਜਿਸ ਨਾਲ਼ ਸਥਾਨਕ ਪਰੰਪਰਾਂ ਅਤੇ ਜੀਵਨ ਢੰਗ ਨੂੰ ਪ੍ਰਭਾਵਿਤ ਹੋਇਆ ਹੈ ਹਾਲਾਂਕਿ ਮੋਹਾਲੀ ਜ਼ਿਲ੍ਹੇ ਨਾਲ਼ ਜੁੜੀਆਂ ਰਹੱਸਮਈ ਜਾਂ ਰਹੱਸਮਈ ਕਹਾਣੀਆਂ ਸ਼ਾਇਦ ਵਿਆਪਕ ਤੌਰ 'ਤੇ ਨਹੀਂ ਮਿਲਦੀਆਂ ਪਰ ਇਹ ਸੱਭਿਆਚਾਰ ਸਿੱਖ ਧਰਮ ਖੇਤੀਬਾੜੀ ਅਤੇ ਪੰਜਾਬੀ ਪਰੰਪਰਾ ਵਿੱਚ ਡੂੰਘੀਆਂ ਜੜ੍ਹਾਂ ਰੱਖਦਾ ਹੈ ਇਹ ਪਹਿਲੂ ਖੇਤਰ ਦੀ ਇਤਿਹਾਸਕ ਅਤੇ ਸੱਭਿਆਚਾਰਕ ਟੇਪਸ਼ਲੀ ਨੂੰ ਦਰਸ਼ਾਉਦਾ ਹੈ ਵਧੇਰੇ ਖਾਸ ਸਥਾਨ ਸਥਾਨਕ ਕਥਾਵਾਂ ਜਾਂ ਕਹਾਣੀਆਂ ਨੂੰ ਉਜਾਗਰ ਕਰਨ ਲਈ ਤੁਹਾਨੂੰ ਸਥਾਨਕ ਨਿਵਾਸਾਂ ਅਤੇ ਇਤਿਹਾਸਕ ਨਾਲ਼ ਜੁੜਕ ਜੁੜਨ ਦੀ ਲੋੜ ਹੋ ਸਕਦੀ ਹੈ ਅਤੇ ਜਿਹਨਾਂ ਦੇ ਖੇਤਰ ਅਤੇ ਇਤਿਹਾਸ ਵਿੱਚ ਡੂੰਘਾਈ ਨਾਲ਼ ਖੋਜ ਕੀਤੀ ਹੈ